ਨੌਜਵਾਨ ਪੀੜ੍ਹੀ ਸੱਭਿਆਚਾਰਕ ਰੀਤਾਂ ਦੀ ਸਖਤੀ ਨਾਲ ਪਾਲਣਾ ਤਾਂ ਨਹੀਂ ਕਰ ਰਹੀ ਪਰ ਇਹਦੇ ਵਿੱਚ ਮੈਂ ਕੋਈ ਗਲਤ ਨਹੀਂ ਸਮਝਦੀ ਕਿਉਂਕਿ ਅੱਜ ਦੇ ਸਮੇਂ ਅਤੇ ਪੁਰਾਣੇ ਸਮੇਂ ਦੇ ਵਿੱਚ ਬਹੁਤ ਜ਼ਿਆਦਾ ਫਰਕ ਪੈ ਗਿਆ ਅਤੇ ਸਮੇਂ ਦੇ ਨਾਲ ਕੁਛ ਚੀਜ਼ਾਂ 'ਚ ਬਦਲਾਵ ਵੀ ਜ਼ਰੂਰੀ ਹੁੰਦਾ ਹੈ ਜੇ ਅਸੀਂ ਆਪਣੇ ਪੁਰਾਣੇ ਸੱਭਿਆਚਾਰ ਨੂੰ ਲੈ ਕੇ ਬੈਠੇ ਰਹਾਂਗੇ ਤਾਂ ਅੱਜ ਦੇ ਸਮੇਂ ਵਿੱਚ ਅੱਗੇ ਵਧਣਾ ਹੋਰ ਵੀ ਮੁਸ਼ਕਿਲ ਹੋ ਜਾਵੇਗਾ ਦੇਖੋ ਸ ਕਮੀਆਂ ਹਰੇਕ ਚੀਜ਼ ਵਿੱਚ ਹੁੰਦੀਆਂ ਨੇ ਚਾਹੇ ਉਹ ਪੁਰਾਣਾ ਸੱਭਿਆਚਾਰ ਹੋਵੇ ਚਾਹੇ ਉਹ ਨਵਾਂ ਕਲਚਰ ਹੋਵੇ ਕੁਛ ਕਹਿ ਸਕਦੇ ਹਾਂ ਆਪਾਂ ਪਰ ਉਹਦੇ ਵਿੱਚ ਸੁਧਾਰ ਲੈ ਕੇ ਆਉਣਾ ਬਹੁਤ ਜ਼ਰੂਰੀ ਆ ਕਿਸੇ ਚੀਜ਼ ਨੂੰ ਸੁੱਤੇ ਸਿੱਧ ਅੱਗੇ ਲੈ ਕੇ ਜਾਣਾ ਇਹ ਵੀ ਗਲਤ ਹੈ ਅੱਜ ਦੀ ਨੌਜਵਾਨ ਪੀੜ੍ਹੀ ਪੜ੍ਹੀ ਲਿਖੀ ਹੈ ਅਤੇ ਕਦਰਾਂ ਕੀਮਤਾਂ ਨੂੰ ਵੀ ਜਾਣਦੀ ਹੈ ਪਰਮਾਤਮਾ ਵਿੱਚ ਵੀ ਵਿਸ਼ਵਾਸ ਕਰਦੀ ਹੈ ਪਰ ਉਹ ਅੰਧ ਭਗਤ ਨਹੀਂ ਹੈ ਉਹ ਅੰਧ ਵਿਸ਼ਵਾਸ਼ ਨਹੀਂ ਕਰਦੀ ਕਿਸੇ 'ਤੇ ਜੋ ਕਿ ਬਹੁਤ ਸਹੀ ਹੈ ਅੱਜ ਸਮਾਜ ਨੇ ਆਪਣਾ ਰੂਪ ਆ ਉਹ ਵਧੀਆ ਹੀ ਕਰ ਲਿਆ ਹੈ ਜਿਵੇਂ ਕਿ ਪਹਿਲਾਂ ਕੁੜੀਆਂ ਨੂੰ ਬਰਾਬਰ ਨਹੀਂ ਸੀ ਸਮਝਿਆ ਜਾਂਦਾ ਅੱਜ ਜੇ ਸਮਾਜ ਅੱਗੇ ਵਧਿਆ ਜੇ ਪੁਰਾਣੀਆਂ ਕਦਰਾਂ ਕੀਮਤਾਂ ਲੋਕਾਂ ਨੇ ਛੱਡੀਆਂ ਨੇ ਤਾਂ ਹੀ ਅੱਜ ਕੁੜੀਆਂ ਨੂੰ ਬਰਾਬ ਬਰਾਬਰ ਦਾ ਸਨਮਾਨ ਮਿਲ ਰਿਹਾ ਅੱਜ ਕੁੜੀਆਂ ਨੂੰ ਮੁੰਡਿਆਂ ਦੇ ਬਰਾਬਰ ਸਮਝਿਆ ਜਾਂਦਾ ਮੈਨੂੰ ਨਹੀਂ ਲੱਗਦਾ ਕਿਸੇ ਵੀ ਘਰ ਚ ਮੁੰਡੇ ਕੁੜੀ ਦੇ ਵਿੱਚ ਵਿਤਕਰਾ ਕੀਤਾ ਜਾਵੇਗਾ ਜੇ ਪੁਰਾਣਾ ਸੱਭਿਆਚਾਰ ਫੋਲੋ ਕਰਦੇ ਤਾਂ ਅੱਜ ਇਹ ਨਹੀਂ ਦੇਖਣ ਨੂੰ ਮਿਲਣਾ ਸੀ ਸੋ ਕੁਝ ਚੰਗੀਆਂ ਗੱਲਾਂ ਵੀ ਹੋਈਆਂ ਨੇ ਤਾਂ ਅਸੀਂ ਕਹਿ ਸਕਦੇ ਹਾਂ ਕਿ ਠੀਕ ਹੈ ਸਾਡਾ ਸੱਭਿਆਚਾਰ ਹੈ ਸਾਨੂੰ ਬਹੁਤ ਪਿਆਰਾ ਹੈ ਅਤੇ ਅਸੀਂ ਇਹਨੂੰ ਅੱਗੇ ਲੈ ਕੇ ਵੀ ਜਾਣਾ ਚਾਹੁੰਦੇ ਹਾਂ ਪੰਜਾਬੀਅਤ ਦੀ ਪਛਾਣ ਹੈ ਜੋ ਉਸਨੂੰ ਅੱਗੇ ਵਧਾਉਣਾ ਵੀ ਚਾਹੀਦਾ ਹੈ ਪਰ ਜੇ ਕੁਛ ਇਹਦੇ ਵਿੱਚ ਸੁਧਾਰ ਆਉਂਦਾ ਜੇ ਨਵਾਂ ਸਮਾਜ ਨਵੀਂ ਸੋਚ ਲੈ ਕੇ ਆਉਂਦਾ ਤਾਂ ਪੁਰਾਣੇ ਲੋਕਾਂ ਨੂੰ ਉਸਨੂੰ ਵੀ ਅਪਣਾਉਣਾ ਚਾਹੀਦਾ ਹੈ ਉਸ ਵਿੱਚ ਵੀ ਹਾਮੀ ਭਰਨੀ ਚਾਹੀਦੀ ਹੈ ਧੰਨਵਾਦ